ਸਾਡੇ ਖੇਤਰ ਵਿੱਚ ਕਬੂਤਰ ਵੱਖ ਵੱਖ ਤਰ੍ਹਾਂ ਦੀਆਂ ਚਿੜੀਆਂ ਅਤੇ ਮੋਰ ਪਾਏ ਜਾਂਦੇ ਹਨ ਮੈਨੂੰ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਵਧੀਆ ਪੰਛੀ ਮੋਰ ਲੱਗਦਾ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਰੰਗ ਬਿਰੰਗਾ ਹੁੰਦਾ ਹੈ ਮੈਨੂੰ ਇਸਨੂੰ ਦੇਖਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਇਹ ਸਾਡਾ ਰਾਸ਼ਟਰੀ ਪੰਛੀ ਹੈ